ਸਲਾਈ ਬੁਣਾਈ ਦਾ ਕੰਮ ਮੈਂ ਚੋਦਾਂ ਪੰਦਰਾਂ ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਮਤਲਬ ਕੀ ਮੈਨੂੰ ਐਨਾ ਵਧੀਆ ਲੱਗਦਾ ਸੀ ਨਾ ਮੇਰੇ ਮੰਮੀ ਕਰਦੇ ਸੀ ਮੰਮੀ ਨੂੰ ਦੇਖ ਕੇ ਦੀਦੀ ਵੀ ਕਰਦੇ ਸੀ ਉਨ੍ਹਾਂ ਨੂੰ ਮੈਂ ਦੇਖ ਦੇਖ ਕੇ ਵੀ ਇਹ ਕੀ ਕਰਦੇ ਰਹਿੰਦੇ ਨੇ ਇਹਨਾਂ ਨੂੰ ਕਿੰਨਾ ਅੱਛਾ ਲੱਗਦਾ ਵਾ ਇਹ ਕਰਨਾ ਤੇ ਮੈਂ ਵੀ ਥੋੜ੍ਹਾ ਥੋੜ੍ਹਾ ਪੁੱਛਣਾ ਸ਼ੁਰੂ ਕਰ ਦਿੱਤਾ ਕੀ ਇਹ ਕੀ ਕਰਦੇ ਪਏ ਓ ਤੁਸੀਂ ਉਨ੍ਹਾਂ ਨੇ ਕੱਟਣਾ ਸੂਟ ਕਰਨਾ ਜੋ ਕੁਛ ਵੀ ਮਤਲਬ ਕੀ ਕਦੀ ਅਮ ਕਦੀ ਮੇਰੇ ਸੂਟ ਮੈਨੂੰ ਬਹੁਤ ਅੱਛਾ ਲਗਨਾ ਕਰਨਾ ਫਿਰ ਮੈਂ ਵੀ ਹੌਲੀ ਹੌਲੀ ਉਨ੍ਹਾਂ ਕੋਲੋਂ ਸਿੱਖ ਕੇ ਉਨ੍ਹਾਂ ਨੂੰ ਪੁੱਛਣਾ ਬਈ ਇਹ ਕਿਵੇਂ ਕੱਟਦੇ ਪਏ ਓ ਉਨ੍ਹਾਂ ਨੇ ਆਪਣੇ ਕੋਲ਼ ਬਾ ਲੈਣਾ ਤੇ ਮੈਨੂੰ ਐਹ ਸਿਖਾਣਾ ਐਂਝ ਪਹਿਲੇ ਸਾਰਾ ਉਹਦੇ ਤੇ ਬਣਾ ਕੇ ਵਈ ਐਂਝ ਕਰਨਾ ਹੈਗਾ ਐਂਝ ਕੱਟਣਾ ਵਾ ਸਾਰਾ ਮੈਨੂੰ ਦੱਸਣਾਂ ਤੇ ਮੈਂ ਸਾਰਾ ਬਹੁਤ ਵਧੀਆ ਕਰਦੀ ਸੀ ਹੌਲੀ ਹੌਲੀ ਮੈਂ ਸਖੀ ਸਿੱਖੀ ਤੇ ਫੇਰ ਮੈਨੂੰ ਆ ਗਿਆ ਸਾਰਾ ਕਰਨਾ ਤੇ ਮੈਨੂੰ ਐਹ ਕੰਮ ਦੀ ਪ੍ਰੇਰਨਾ ਵੀ ਉਨ੍ਹਾਂ ਕੋਲੋਂ ਈ ਮੰਮੀ ਕੋਲੋਂ ਔਰ ਦੀਦੀ ਕੋਲੋਂ ਮਿਲੀ ਤੇ ਮੈਂ ਸਭ ਤੋਂ ਪਹਿਲੇ ਆਪਣੇ ਨਾ ਪਾਪਾ ਦੀ ਇੱਕ ਸ਼ਰਟ ਜਹੀ ਬਣਾਈ ਉਹ ਮੇਰੇ ਪਾਪਾ ਨੂੰ ਐਨੀ ਵਧੀਆ ਲੱਗਦੀ ਸੀ ਕੀ ਉਹ ਉਹ ਸ਼ਰਟ ਈ ਨਾ ਬਹੁਤ ਵਾਰੀ ਪਾਂਦੇ ਸੀ ਜਦੋਂ ਵੀ ਕਿਤੇ ਜਾਣਾ ਉਹੀ ਸ਼ਰਟ ਪਾਂਦੇ ਸੀ ਉਹ ਕਹਿੰਦੇ ਸੀ ਕੀ ਐਹ ਮੈਨੂੰ ਬਹੁਤ ਵਧੀਆ ਲੱਗਦੀ ਹੈ ਚਲੋ ਜੀ ਅੱਛਾ ਜੀ ਧੰਨਵਾਦ ਜੀ